ਹਾਂਜੀ ਸਤਿ ਸ਼੍ਰੀ ਅਕਾਲ ਹਾਂ ਹਾਂ ਮਨਦੀਪ ਸਿੰਘ ਬੋਲ ਰਿਹਾ ਤੁਸੀਂ ਕੌਣ ਬੋਲਦੇ ਆ ਓ ਅੱਛਾ ਅੱਛਾ ਮੇਰੇ ਚਾਚਾ ਜੀ ਦੀ ਲੜਕੀ ਹਾਂਜੀ ਹਾਂਜੀ ਮਨੀਸ਼ਾ ਬੋਲੋ ਵਧੀਆ ਵਧੀਆ ਮਨੀਸ਼ਾ ਕਿੱਥੇ ਰਹਿੰਦੇ ਜੀ ਅੱਜ ਕੱਲ੍ਹ ਅੱਛਾ ਤਦ ਹੀ ਨਹੀਂ ਦਿਖੇ ਤੁਸੀਂ ਹੁਣ ਅੱਜ ਕੱਲ੍ਹ ਅੱਛਾ ਘਰ ਠੀਕ ਹੈ ਸਾਰੇ ਵਧੀਆ ਵਧੀਆ ਹਾਂਜੀ ਦੱਸੋ ਸਾਡੇ ਘਰ ਤੋਂ ਤਾਂ ਇਹ ਬਾਗਾ ਬੋਡਰ ਜਿਹੜਾ ਹੈਗਾ ਵਾ ਸਾਰਾ ਦਸ ਕੁ ਕਿਲੋਮੀਟਰ ਪੈਂਦਾ ਵਾ ਅਤੇ ਉਸ ਤੋਂ ਕਿਲੋ ਕੁ ਮੀਟਰ ਗਾੜੀ ਪਾਕਿਸਤਾਨ ਹੁੰਦਾ ਵਾ

ਪਾਕਿਸਤਾਨ ਜਾਣ ਲਈ ਪਹਿਲਾਂ ਤਾਂ ਤੁਹਾਨੂੰ ਪਾਸਪੋਰਟ ਚਾਹੀਦਾ ਹੋਣਾ ਪਾਸਪੋਰਟ ਹੈ ਤੁਹਾਡੇ ਕੋਲ ਪਾਸਪੋਰਟ ਹੈ ਅਤੇ ਉਤੇ ਫਿਰ ਤੁਹਾਨੂੰ ਵੀਜ਼ਾ ਲਗਵਾਉਣਾ ਪਵੇਗਾ ਅਤੇ ਵੀਜ਼ਾ ਤੁਹਾਡਾ ਬਾਹਰੋਂ ਹੀ ਲੱਗੇਗਾ ਦਿੱਲੀ ਸਾਈਡ ਤੋਂ ਹੀ ਲੱਗੇਗਾ ਮੇਰੇ ਖਿਆਲ ਨਾਲ ਤਾਂ ਜਿੰਨੀ ਕੁ ਮੈਨੂੰ ਨੌਲੇਜ ਹਾਂਜੀ ਹਾਂਜੀ ਮੈਨੂੰ ਤਾਂ ਇੰਨੀ ਕੁ ਨੌਲੇਜ ਹੈਗੀ ਦਿੱਲੀਓਂ ਲੱਗਦਾ ਹੈ ਵੀਜ਼ਾ ਅਤੇ ਬਟ ਇਹ ਵੀ ਹੈ ਕਿ ਅਗਰ ਤੁਸੀਂ ਉੱਥੇ ਪਹਿਲਾਂ ਵੀਜ਼ਾ ਲਵਾ ਲੈਂਦੇ ਜੇ ਪਾਕਿਸਤਾਨ ਦਾ ਪਾਸਪੋਰਟ ਉੱਤੇ ਤਾਂ ਫਿਰ ਤੁਸੀਂ ਹੋਰ ਕਿਸੇ ਮੁਲਕ ਨਹੀਂ ਜਾ ਸਕਦੇ ਅਗਰ ਉਹਦੀ ਸਟੈਂਪ ਲੱਗ ਜੇ ਇਹਦੇ ਬਾਰੇ ਮੈਨੂੰ ਇੰਨੀ ਕਲੈਰਟੀ ਨਹੀਂ ਹੈ ਪਾਕਿਸਤਾਨ ਦੇ ਵੀਜ਼ੇ ਬਾਰੇ ਹਾਂ ਮੈਂ ਤੁਹਾਨੂੰ ਪਤਾ ਕਰਕੇ ਦੱਸ ਦਾਂਗਾ ਮੇਰੇ ਇੱਕ ਦੋ ਏਜੰਟ ਵਗੈਰਾ ਹੈ ਨੇ ਇੱਥੇ ਰਣਜੀਤ ਐਵਨਿਊ ਸਾਈਡ 'ਤੇ ਨਹੀਂ ਤਾਂ ਤੁਹਾਨੂੰ ਮੈਂ ਤੁਹਾਨੂੰ ਉਹਨਾਂ ਦਾ ਕੋਂਟੈਕਟ ਨੰਬਰ ਦੇ ਦਾਂਗਾ ਮੈਂ ਆਪ ਕਹਿ ਦਾਂਗਾ ਕਿ ਮੇਰੀ ਇੱਦਾਂ ਚਾਚਾ ਜੀ ਦੀ ਲੜਕੀ ਉਹਨਾਂ ਨੇ ਜਾਣਾ ਵਾ ਅਤੇ ਉਹ ਤੁਹਾਨੂੰ ਗਾਈਡ ਕਰ ਦੇਣਗੇ ਅਤੇ ਉਹਨਾਂ ਦਾ ਨਾਂ ਹੈਗਾ ਵਾ ਨਵਦੀਪ ਸਿੰਘ ਨਾਂ ਉਹਨਾਂ ਦਾ ਅਤੇ ਬਹੁਤ ਵਧੀਆ ਬੰਦੇ ਹੈਗੇ ਆ ਅਤੇ ਤੁਹਾਨੂੰ ਗਾਈਡ ਵਗੈਰਾ ਸਾਰਾ ਕਰ ਦੇਣਗੇ ਠੀਕ ਹੈ ਅਤੇ ਕਿਹੜੇ ਵਕਤ ਵਿਹਲੇ ਹੁੰਦੇ ਤੁਹਾਨੂੰ ਮੈਂ ਕੋਲ ਕਰਵਾ ਦਾਂਗਾ ਨਹੀਂ ਤਾਂ ਉਹਨਾਂ ਕੋਲੋਂ ਅੱਛਾ ਠੀਕ ਹੈ ਮੈਂ ਤੁਹਾਨੂੰ ਫਿਰ ਨਾ ਸ਼ਾਮ ਨੂੰ ਕੋਲ ਕਰਵਾ ਦਾਂਗਾ ਕਿਤੇ ਤੁਹਾਨੂੰ ਮੈਂ ਮੈਸ ਮੈਂ ਨੰਬਰ ਵਗੈਰਾ ਵੀ ਦੇ ਦਿਆਂਗਾ ਅਤੇ ਦੱਸ ਵੀ ਦਿਆਂਗਾ ਉਹਨਾਂ ਦੀ ਕੋਲ ਆਉਣੀ ਤੁਹਾਨੂੰ ਠੀਕ ਹੈ ਓਕੇ